ਖੇਡਾਂ ਸਾਡੇ ਸ਼ਰੀਰ ਦਾ ਅਨਿੱਖਵਾਂ ਅੰਗ ਹਨ ਖੇਡਾਂ ਹਰ ਇੱਕ ਵਿਅਕਤੀ ਲਈ ਬਹੁਤ ਜ਼ਰੂਰੀ ਹਨ ਖੇਡਾਂ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਉੱਥੇ ਬੰਦੇ ਨੂੰ ਕੋਈ ਵੀ ਮਾਨਸਿਕ ਤੌਰ 'ਤੇ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਖੇਡਾਂ ਦੇ ਨਾਲ ਹਰ ਇੱਕ ਇਨਸਾਨ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਔਰ ਹਰ ਵਿਅਕਤੀ ਜਿਹੜਾ ਹੈਗਾ ਖੇਡਾਂ ਦੇ ਨਾਲ ਰਿਸ਼ਟ ਪੁਸ਼ਟ ਰਹਿੰਦਾ ਹਰ ਇੱਕ ਵਿਅਕਤੀ ਨੂੰ ਆਪਣੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਖੇਡ ਨੂੰ ਅਡੋਪਟ ਕਰਨਾ ਜ਼ਰੂਰੀ ਹੈ ਔਰ ਉਹਨੂੰ ਕਿਸੇ ਨਾ ਕਿਸੇ ਖੇਡ ਦੇ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਹੈ